ਹਾਂਜੀ ਮੈਂ ਤੁਹਾਨੂੰ ਆਪਣੀ ਨੌਕਰੀ ਬਾਰੇ ਦੱਸਣ ਜਾ ਰਿਹਾ ਹਾਂ ਅਸੀਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਗ੍ਰੰਥੀ ਸਿੰਘ ਦੀ ਨੌਕਰੀ ਕਰਨੀ ਸੀ ਚਲੋ ਜੀ ਸਾਡੀਆਂ ਅਖ਼ਬਾਰ 'ਚ ਪੋਸਟਾਂ ਨਿਕਲੀਆਂ ਭਰਤੀ ਨਿਕਲੀਆਂ ਗ੍ਰੰਥੀ ਸਿੰਘਾਂ ਦੀਆਂ ਅਤੇ ਅਸੀਂ ਅ ਮੇਰੇ ਮਾਮਾ ਜੀ ਨੇ ਮੈਨੂੰ ਫੋਨ ਕੀਤਾ ਕਿ ਮੈਂ ਆਪਣਾ ਬੇਟਾ ਤੇਰੇ ਕੋਲ ਭੇਜਣ ਲੱਗਿਆ ਹਾਂ ਨਾਲੇ ਆਪ ਤੂੰ ਤਿਆਰੀ ਕਰ ਲਈ ਨਾਲੇ ਉਸ ਨੂੰ ਤਿਆਰੀ ਕਰਵਾ ਦਈ ਟੈਸਟ ਦੀ ਮੈਂ ਕਿਹਾ ਠੀਕ ਹੈ ਮਾਮਾ ਜੀ ਭੇਜ ਦਿਓ ਚਲੋ ਜੀ ਉਹਨਾਂ ਦਾ ਬੇਟਾ ਮੇਰੇ ਕੋਲ ਆ ਗਿਆ ਅਸੀਂ ਸਾਰੀ ਰਾਤ ਪੜ੍ਹਦੇ ਰਹੇ ਤਿਆਰੀ ਕਰਦੇ ਰਹੇ ਸਟੱਡੀ ਕਰਦੇ ਰਹੇ ਦੂਸਰੇ ਦਿਨ ਅ ਸਾਡਾ ਟੈਸਟ ਸੀਗਾ ਅਸੀਂ ਸਵੇਰੇ ਛੇ ਵਜੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ ਉੱਥੇ ਹੋਰ ਵੀ ਵੱਖ ਵੱਖ ਜ਼ਿਲ੍ਹਿਆਂ ਤੋਂ ਬਹੁਤ ਜ਼ਿਆਦਾ ਸੰਗਤ ਆਈ ਸੀ ਲੋਕ ਆਏ ਸਨ ਜਿਨ੍ਹਾਂ ਨੇ ਟੈਸਟ ਦੇਣਾ ਸੀ ਅਤੇ ਅਸੀਂ ਜਾ ਕੇ ਮੱਥਾ ਟੇਕਿਆ ਦਰਸ਼ਨ ਦੀਦਾਰੇ ਕੀਤੇ ਨਾਲੇ ਸ਼੍ਰੀ ਅਨੰਦਪੁਰ ਸਾਹਿਬ ਚਲੋ ਜੀ ਸਾਡਾ ਉੱਥੇ ਬਹੁਤ ਜ਼ਿਆਦਾ ਸੰਗਤ ਹੋਣ ਕਰਕੇ ਸਾਡਾ ਰਾਤ ਨੂੰ ਸਾਢੇ ਨੌ ਵਜੇ ਟੈਸਟ ਹੋਇਆ ਅਸੀਂ ਸਾਰੀ ਦਿਹਾੜੀ ਨਾਲੇ ਸਟੱਡੀ ਵੀ ਕਰਦੇ ਰਹੇ ਪੜ੍ਹਦੇ ਵੀ ਰਹੇ ਥੋੜ੍ਹੀ ਬੇਚੈਨੀ ਵੀ ਸੀ ਸਾਨੂੰ ਵੀ ਕਦੋਂ ਹੋਊਗਾ ਟੈਸਟ ਕਦੋਂ ਹੋਊਗਾ ਕਦੋਂ ਹੋਊਗਾ ਪਰ ਸਾਡਾ ਟੈਸਟ ਰਾਤ ਨੂੰ ਸਾਢੇ ਨੌ ਵਜੇ ਹੋਇਆ ਚਲੋ ਅਸੀਂ ਟੈਸਟ ਦਿੱਤਾ ਜੀ ਰਾਤ ਨੂੰ ਸਾਢੇ ਨੌ ਵਜੇ ਟੈਸਟ ਦੇਣ ਤੋਂ ਬਾਅਦ ਅਗਲੇ ਦਿਨ ਸਾਡਾ ਰਿਜਲਟ ਆਉਣਾ ਸੀ ਅਸੀਂ ਸਾਡੇ ਅ ਅ ਟੈਸਟ ਦੇਣ ਤੋਂ ਬਾਅਦ ਅਸੀਂ ਘਰ ਆ ਗਏ ਸਾਢੇ ਨੌ ਦਸ ਵਜੇ ਅਸੀਂ ਉੱਥੋਂ ਤੁਰੇ ਅਤੇ ਰਾਤ ਨੂੰ ਸਾਢੇ ਗਿਆਰਾਂ ਵਜੇ ਅਸੀਂ ਆਪਣੇ ਘਰ ਆ ਗਏ ਚਲੋ ਘਰ ਆਉਣ ਤੋਂ ਬਾਅਦ ਜੀ ਅਸੀਂ ਸੌਂ ਕੇ ਦੂਸਰੇ ਦਿਨ ਸਾਡਾ ਰਿਜ਼ਲਟ ਆਉਣਾ ਸੀ ਪਰ ਸਾਡਾ ਰਿਜ਼ਲਟ ਆਇਆ ਨਹੀਂ ਕਿਉਂ ਕਰਕੇ ਸ਼੍ਰੋਮਣੀ ਕਮੇਟੀ ਦਾ ਅ ਜਿਹੜਾ ਪ੍ਰਧਾਨ ਸੀ ਉਹ ਚੇਂਜ ਹੋ ਗਿਆ ਬਦਲ ਗਿਆ ਜਿਹੜਾ ਨਵਾਂ ਪਰਧਿਆ ਪ੍ਰਧਾਨ ਨਿਯੁਕਤ ਕੀਤਾ ਸੀ ਉਹ ਕਹਿੰ ਉਸਨੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਬੰਦਾ ਨਹੀਂ ਰੱਖਣਾ ਹੈਗਾ ਨੌਕਰੀ 'ਤੇ ਚਲੋ ਅਸੀਂ ਇੱਕ ਸਾਲ ਤੱਕ ਵੇਟ ਕਰਦੇ ਰਹੇ ਸਾਡਾ ਕੋਈ ਵੀ ਸਾਨੂੰ ਉਹ ਨਹੀਂ ਮਿਲਿਆ ਹੈ ਅ ਨੌਕਰੀ ਸਾਨੂੰ ਮਿਲੀ ਨਹੀਂ ਹੈ ਚਲੋ ਇੱਕ ਸਾਲ ਤੋਂ ਬਾਅਦ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਹਤਬਾਰ ਸਿੰਘ ਸਾਹਿਬਾਨ ਸੀ ਉਹਨਾਂ ਨੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਪ੍ਰਧਾਨ ਜੀ ਗੁਰਦੁਆਰਿਆਂ 'ਚ ਗ੍ਰੰਥੀ ਸਿੰਘ ਨਹੀਂ ਹਨ ਤੋ ਕਿਰਪਾ ਕਰਕੇ ਗ੍ਰੰਥੀ ਸਿੰਘਾਂ ਨੂੰ ਭਰਤੀ ਕੀਤਾ ਜਾਵੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹੜਾ ਸਾਡਾ ਇੱਕ ਸਾਲ ਪਹਿਲਾਂ ਟੈਸਟ ਲਿਆ ਸੀ ਉਸ ਦੇ ਵਿੱਚੋਂ ਹੀ ਸਾਨੂੰ ਭਰਤੀ ਕੀਤਾ ਗਿਆ ਸਾਡਾ ਜੋਆਇਨਿੰਗ ਲੈਟਰ ਆ ਗਿਆ ਅਤੇ ਅਸੀਂ ਆਪਣੇ ਡਾਕੂਮੈਂਟ ਵਗੈਰਾ ਸਾਰਾ ਕੁਝ ਜਮ੍ਹਾਂ ਕਰਵਾ ਦਿੱਤਾ ਜਮ੍ਹਾਂ ਕਰਵਾਉਣ ਤੋਂ ਬਾਅਦ ਇੱਕ ਮਹੀਨਾ ਅਸੀਂ ਫਿਰ ਵੇਟ ਕਰਦੇ ਰਹੇ ਇੱਕ ਮਹੀਨੇ ਵੇਟ ਤੋਂ ਬਾਅਦ ਸਾਡਾ ਜੋਇਨਿੰਗ ਲੈਟਰ ਆਇਆ ਅਸੀਂ ਗੁਰਦੁਆਰਾ ਸਾਹਿਬ 'ਚ ਭਰਤੀ ਹੋਏ ਸਡੂ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਨੂੰ ਨੌਕਰੀ ਮਿਲ ਗਈ ਅੱਜ ਅਸੀਂ ਨੌਕਰੀ ਕਰ ਰਹੇ ਹਾਂ ਜੀ